ਮੈਂ ਪਟਿਆਲੇ ਵਿੱਚ ਰਹਿੰਦੀ ਹਾਂ ਅਤੇ ਮੇਰੇ ਸ਼ਹਿਰ ਪਟਿਆਲੇ ਵਿੱਚ ਬਹੁਤ ਸ ਸਾਰੀਆਂ ਥਾਵਾਂ ਘੁੰਮਣਯੋਗ ਹਨ ਜਿਵੇਂ ਕਿ ਸ਼੍ਰੀ ਗੁਰੂਦੁਆਰਾ ਮੋਤੀ ਬਾਗ ਸਾਹਿਬ ਜੀ ਅਤੇ ਰਾਜੇ ਦਾ ਕਿਲ੍ਹਾ ਅਤੇ ਕਿਲ੍ਹਾ ਚੌਂਕ ਜਿਸ ਨੂੰ ਕਿਲ੍ਹਾ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਰਾਜੇ ਦਾ ਕਿਲ੍ਹਾ ਜਿਸ ਵਿੱਚ ਘੁੰਮਣਾ ਮੈਨੂੰ ਬਹੁਤ ਪਸੰਦ ਹੈ ਉਸ ਵਿੱਚ ਬਹੁਤ ਸਾਰੀਆਂ ਇਤਿਹਾਸਿਕ ਤਸਵੀਰਾਂ ਹਨ ਅਤੇ ਰਾਜਾ ਦੇ ਸਮੇਂ ਦੀਆਂ ਤੋਪਾਂ ਬੰਦੂਕਾਂ ਉਨ੍ਹਾਂ ਦੇ ਕੀਤੇ ਹੋਏ ਸਾਰੇ ਹੀ ਫੌਜ ਦੌਰ ਸਾਰੇ ਉੱਥੇ ਸਥਿਤ ਹਨ ਜੋ ਦੇਖ ਕੇ ਮੈਨੂੰ ਬਹੁਤ ਹੀ ਅੱਛਾ ਮਹਿਸੂਸ ਹੁੰਦਾ ਹੈ ਅਤੇ ਮੈਂ ਆਪਣੇ ਪਟਿਆਲੇ ਸ਼ਹਿਰ ਤੋਂ ਬਾਹਰ ਵੀ ਘੁੰਮਣਾ ਚਾਹੁੰਦੀ ਹਾਂ ਪਰ ਮੈਨੂੰ ਮੇਰੇ ਸ਼ਹਿਰ ਵਿੱਚ ਘੁੰਮਣਾ ਜ਼ਿਆਦਾ ਪਸੰਦ ਹੈ